ਐਲਪੀਜੀ ਸਲੰਡਰ ਨੂੰ ਵਰਤਦੇ ਸਮੇਂ ਸਾਵਧਾਨੀ ਇੱਕ ਤਾਂ ਸਾਨੂੰ ਇਹਦਾ ਇਹਦੀ ਲੀਕੇਜ ਚੈੱਕ ਕਰਕੇ ਕਰਦੇ ਰਹਿਣਾ ਚਾਹੀਦਾ ਅਤੇ ਗੈਸ ਸਿਲੰਡਰ ਨੂੰ ਹਮੇਸ਼ਾ ਸਿੱਧਾ ਕਰਕੇ ਰੱਖਣਾ ਚਾਹੀਦਾ ਨਾ ਕਿ ਆਪਾਂ ਟੇਢਾ ਕਰਕੇ ਰੱਖ ਕੇ ਇਹਦੇ ਨਾਲ ਇੱਕ ਇਹਦਾ ਜਿਹੜਾ ਲਿਕੁਇਡ ਹੁੰਦਾ ਇਹਦੇ ਅੰਦਰ ਉਹ ਉਹਦੇ ਵਿੱਚ ਆ ਜਾਂਦਾ ਪਾਈਪ ਦੇ ਇਸ ਕਰਕੇ ਸਾਨੂੰ ਸਿਲੰਡਰ ਨੂੰ ਸਿੱਧਾ ਕਰਕੇ ਰੱਖਣਾ ਚਾਹੀਦਾ ਅਤੇ ਇੱਕ ਚੁੱਲ੍ਹੇ ਤੋਂ ਹਮੇਸ਼ਾ ਦੂਰ ਰੱਖਣਾ ਚਾਹੀਦਾ ਇਹਨੂੰ ਅਤੇ ਚੁੱਲ੍ਹਾ ਹਮੇਸ਼ਾ ਦੂਰ ਰੱਖਣਾ ਚਾਹੀਦਾ ਅਤੇ ਜਦੋਂ ਵੀ ਗੈਸ ਨੂੰ ਚਾਲੂ ਕਰਨਾ ਤਾਂ ਇਹਨੂੰ ਲਾਈਟਰ ਨਾਲ ਚਲਾਉਣਾ ਚਾਹੀਦਾ ਅਤੇ ਜਦੋਂ ਵੀ ਚੁੱਲ੍ਹਾ ਇ ਸਟਾਰਟ ਕਰਨਾ ਤਾਂ ਉਹਨੂੰ ਲਾਈਟਰ ਦੇ ਨਾਲ ਚਾਲੂ ਕਰਨਾ ਚਾਹੀਦਾ ਅਤੇ ਇਹਨੂੰ ਅੱਗ ਤੋਂ ਬਹੁਤ ਪਰੇ ਰੱਖਣਾ ਚਾਹੀਦਾ ਕੋਈ ਵੀ ਜਲਨਸ਼ੀਲ ਜਿਹੜੇ ਪਦਾਰਥ ਹੁੰਦੇ ਆ ਮਿੱਟੀ ਦਾ ਤੇਲ ਕੋਈ ਲੈਂਪ ਆ ਉਹਦੇ ਤੋਂ ਦੂਰ ਰੱਖਣਾ ਚਾਹੀਦਾ ਵਾ ਸਿਲਿੰਡਰ ਨੂੰ ਅਤੇ ਇਹਦਾ ਢੱਕਣ ਹਮੇਸ਼ਾ ਕੱਸ ਕੇ ਬੰਦ ਕਰਕੇ ਰੱਖਣਾ ਚਾਹੀਦਾ ਵਾ ਜਦੋਂ ਵੀ ਤੁਸੀਂ ਸਿਲਿੰਡਰ ਨੂੰ ਈਵਨ ਕਿ ਜਦੋਂ ਸਿਲਿੰਡਰ ਖਾਲੀ ਵੀ ਹੋ ਜਾਂਦਾ ਵਾ ਤਾਂ ਵੀ ਇਹਦਾ ਢੱਕਣ ਟਾਈਟ ਕਰਕੇ ਰੱਖਣਾ ਚਾਹੀਦਾ ਅਤੇ ਇਹਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇਹਦਾ ਜਿਹੜਾ ਰੈਗੂਲੇਟਰ ਆ ਉਹ ਬੰਦ ਕਰ ਦੇਣਾ ਚਾਹੀਦਾ ਸੌਣ ਤੋਂ ਪਹਿਲਾਂ ਤਾਂ ਕਿ ਗੈਸ ਲੀਕ ਵੀ ਹੁੰਦੀ ਰਵੇ ਤਾਂ ਵੀ ਉਹਦਾ ਜਿਹੜਾ ਸਵਿੱਚ ਬੰਦ ਕਰਕੇ ਰੱਖਣਾ ਚਾਹੀਦਾ ਵਾ ਅਤੇ ਘਰ ਦੇ ਜਿਹੜੀਆਂ ਕਿਚਨ ਦੀਆਂ ਦਰਵਾਜ਼ੇ ਬਾਰੀਆਂ ਨੇ ਉਹਨਾਂ ਨੂੰ ਖੋਲ੍ਹ ਕੇ ਸੌਣਾ ਚਾਹੀਦਾ ਹਮੇਸ਼ਾ ਅਤੇ ਇਹਦਾ ਰੈਗੂਲੇਟਰ ਜਿਹੜਾ ਟ ਸਮੇਂ ਸਮੇਂ 'ਤੇ ਚੈੱਕ ਕਰਦੇ ਰਹਿਣਾ ਚਾਹੀਦਾ ਤਾਂ ਕਿ ਗੈਸ ਨਾ ਲੀਕ ਹੋਵੇ